ਮੈਂ ਜਸਪ੍ਰੀਤ ਕੌਰ ਪਿੰਡ ਹੰਢਿਆਇਆ ਜ਼ਿਲ੍ਹਾ ਬਰਨਾਲੇ ਦੀ ਵਸਨੀਕ ਹਾਂ ਸਾਡੇ ਮੈਂ ਬਰਨਾਲਾ ਐਸ ਡੀ ਕਾਲਜ ਜਿਹੜਾ ਕਿ ਸਾਡੇ ਪਿੰਡ ਤੋਂ ਦੋ ਤਿੰਨ ਕਿਲੋਮੀਟਰ ਹੀ ਦੂਰ ਹੈ ਉੱਥੇ ਸਟਡੀ ਆਪਣੀ ਕੰਪਲੀਟ ਕਰ ਰਹੀ ਹਾਂ ਉੱਥੇ ਸਾਡੇ ਵੱਖੋ ਵੱਖਰੇ ਲੋਕ ਨਾਚ ਕਰਵਾਏ ਜਾਂਦੇ ਹਨ ਜਿਸ ਵਿੱਚ ਸਾਡੇ ਪਿੰਡ ਦੇ ਨੌਜਵਾਨ ਵੀ ਹਿੱਸਾ ਲੈਂਦੇ ਹਨ ਉਸ ਵਿੱਚ ਵੱਖ ਵੱਖ ਤਰ੍ਹਾਂ ਦੇ ਲੋਕ ਨਾਚ ਕਰਵਾਏ ਜਾਂਦੇ ਹਨ ਉਸ ਵਿੱਚ ਸਾਡੇ ਪਿੰਡ ਦੇ ਨੌਜਵਾਨ ਬਹੁਤ ਹੀ ਜ਼ਿਆਦਾ ਦਿਲਚਸਪੀ ਦਿਖਾਉਂਦੇ ਹਨ ਅਤੇ ਵੱਧ ਚੜ੍ਹ ਕੇ ਉਸ ਵਿੱਚ ਹਿੱਸਾ ਲੈਂਦੇ ਹਨ ਅਤੇ ਵਧੀਆ ਪ੍ਰਦਰਸ਼ਨ ਕਰਦੇ ਸਨ ਉਹ ਇਸ ਪ੍ਰਕਿਰਿਆ ਇਸ ਲੋਕ ਨਾਚ ਵਿੱਚ ਆਪਣਾ ਕਿਰਦਾਰ ਨਿਭਾਉਣ ਲਈ ਉਹ ਹਮੇਸ਼ਾ ਅੱਗੇ ਖੜ੍ਹੇ ਰਹਿੰਦੇ ਹਨ ਇਸ ਲੋਕ ਨਾਚ ਦਾ ਮਹੱਤਵ ਇਹ ਹੈ ਸਕੂਲਾਂ ਵਿੱਚ ਕਾਲਜਾਂ ਵਿੱਚ ਵੀ ਇਸ ਨੂੰ ਕਰਵਾਇਆ ਜਾਂਦਾ ਹੈ ਤਾਂ ਕਿ ਅਸੀਂ ਆਪਣੇ ਪੁਰਾਣੇ ਸੱਭਿਆਚਾਰ ਨੂੰ ਦੁਬਾਰਾ ਉਜਾਗਰ ਕਰ ਸਕੀਏ ਅਤੇ ਉਸ ਵੱਲ ਧਿਆਨ ਦੇ ਸਕੀਏ ਕਿ ਸਾਡੇ ਪੁਰਾਣੇ ਸਮੇਂ ਵਿੱਚ ਇਸ ਤਰ੍ਹਾਂ ਦੇ ਲੋਕ ਨਾਚ ਗਿੱਧੇ ਭੰਗੜੇ ਅਤੇ ਹੋਰ ਕਈ ਤਰ੍ਹਾਂ ਦੇ ਲੋਕ ਨਾਚ ਕਰਵਾਏ ਜਾਂਦੇ ਸੀ ਜਿਸ ਵਿੱਚ ਜਿਸ ਵਿੱਚ ਨੌਜਵਾਨ ਪੱਗਾਂ ਬੰਨ੍ਹ ਕੇ ਕੁੜਤਾ ਚਾਦਰਾ ਬੰਨ੍ਹ ਕੇ ਆਪਣਾ ਮਤਲਬ ਕਿਰਦਾਰ ਨਿਭਾਉਂਦੇ ਹਨ ਅਤੇ ਆਪਣਾ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਸਭ ਤੋਂ ਜ਼ਿਆਦਾ ਨੌਜਵਾਨ ਪੀੜ੍ਹੀ ਜੋ ਇਸ ਵਿੱਚ ਹਿੱਸਾ ਲੈਂਦੀ ਹੈ ਲੋ ਨਹੀਂ ਤਾਂ ਅੱਜ ਕੱਲ੍ਹ ਦੇ ਬੱਚੇ ਨਸ਼ਿਆਂ ਵੱਲ ਤੁਰ ਰਹੇ ਹਨ ਤਾਂ ਉਹਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿ ਆਪਣੇ ਲੋਕ ਨਾਚ ਆਪਣੇ ਸੱਭਿਆਚਾਰ ਵੱਲ ਧਿਆਨ ਦੇਣ ਤਾਂ ਕਿ ਉਹ ਗਲਤ ਕੰਮਾਂ ਵਿੱਚ ਨਾ ਪੈ ਸਕਣ ਅਤੇ ਆਪਣੇ ਸੱਭਿਆਚਾਰ ਨੂੰ ਬਣਾਈ ਰੱਖਣ ਸਕੂਲਾਂ ਕਾਲਜਾਂ ਵਿੱਚ ਇਸ ਨੂੰ ਕਰਵਾਉਣ ਦਾ ਮਹੱਤਵ ਇਹੀ ਹੈ ਤਾਂ ਕਿ ਸਾਰੇ ਆਪਣੇ ਸੱਭਿਆਚਾਰਕ ਬਣਾਈ ਰੱਖਣ ਅਤੇ ਆਪਣੇ ਸੱਭਿਆਚਾਰ 'ਤੇ ਧਿਆਨ ਦੇਣ ਅਤੇ ਲੋਕ ਨਾਚ 'ਚ ਦਿਲਚਸਪੀ ਲਈ ਹੈ ਜਿਸ ਨਾਲ ਵਧੀਆ ਪ੍ਰਦਰਸ਼ਨ ਪੈਦਾ ਹੁੰਦਾ ਹੈ